ਹੈਲੋ

ਹਾਂਜੀ ਮੈਂ ਸਿਮਰਪ੍ਰੀਤ ਸਿੰਘ ਪੰਜਾਬੀ ਯੂਨੀਵਰਸਿਟੀ ਦਾ ਪ੍ਰੋਫੈਸਰ ਗੱਲ ਕਰ ਰਿਹਾ ਜੀ ਤੁਸੀਂ ਕੌਣ ਹਾਂਜੀ ਹਾਂਜੀ ਜੀ ਸਾਡੇ ਪੰਜਾਬੀ ਯੂਨੀਵਰਸਿਟੀ ਇਹ ਬ ਬਹੁਤ ਵੱਡੀ ਯੂਨੀਵਰਸਿਟੀ ਹੈ ਜੀ ਇਹਦੇ ਵਿੱਚ ਬਹੁਤ ਸਾਰੇ ਕੋਲਜ ਆਉਂਦੇ ਨੇ ਪੰਜਾਬੀ ਯੂਨੀਵਰਸਿਟੀ ਵਿੱਚ ਤੁਹਾਡੇ ਕਮਰਸ ਟੀਮ ਦੇ ਰਿਲੇਟਿਡ ਅੱਗੇ ਬਹੁਤ ਸਾਰੇ ਕੋਰਸ ਨੇ ਜਿਵੇਂ ਤੁਸੀਂ ਬੈਚਲਰ ਕੋਰਸ ਦੀ ਗੱਲ ਕਰਦੇ ਓਂ ਤਾਂ ਬੀਕੌਮ ਬੀਕੌਮ ਸਿੰਪਲ ਆ ਜਾਂਦੀ ਹੈ ਉਹ 'ਚ ਕਾਫੀ ਸਬਜੈਕਟ ਨੇ ਆਪਣੇ ਬੀਕੌਮ ਓਨਰਸ ਆ ਜਾਂਦੀ ਹੈ ਜੀ ਉਹ ਥੋੜ੍ਹੀ ਜੀ ਬੀਕੌਮ ਤੋਂ ਐਡਵਾਂਸ ਹੁੰਦੀ ਹੈ ਜੀ ਉਸ 'ਚ ਵਧੀਆ ਪੜ੍ਹਾਈ ਹੁੰਦੀ ਹੈ ਜੀ ਜੀ ਇਹ ਸਰਕਾਰੀ ਯੂਨੀਵਰਸਿਟੀ ਹੈ ਇੱਕ ਵੈਸੇ ਮੈਂ ਮੈਂ ਹੈਗਾ ਮੈਂ ਹੈਗਾ ਵੈਸੇ ਸਾਇੰਸ ਦਾ ਪ੍ਰੋਫੈਸਰ ਵੈਸੇ ਤੁਸੀਂ ਉਰੇ ਆ ਕੇ ਇੱਕ ਵਾਰ ਵਿਜਿਟ ਕਰਕੇ ਪੁੱਛ ਸਕਦੇ ਓਂ ਕਿ ਕਿੰਨੀ ਖਰਚਾ ਹੈ ਤੁਸੀਂ ਉਹ ਫੀਸ ਡਿਪਾਰਟਮੈਂਟ 'ਚ ਪਤਾ ਲੱਗੇਗਾ ਜੀ ਹਾਲੇ ਮੈਂ ਹੈਗਾ ਸਾਇੰਸ ਦਾ ਪ੍ਰੋਫੈਸਰ ਜੀ ਵੈਸੇ ਆਹ ਸਰਕਾਰੀ ਸੰਸਥਾ ਹੋਣ ਕਰਕੇ ਵੈਸੇ ਉਰੇ ਫੀਸ ਜ਼ਿਆਦਾ ਤਾਂ ਨਹੀਂ ਹੋਏਗੀ ਬਟ ਸਮੈਸਟਰ ਬੇਸਡ ਹੋਏਗੀ ਜੀ ਫੀਸ ਸਾਲ ਦੇ ਬੇਸ 'ਤੇ ਨਹੀਂ ਹੋਏਗੀ ਹਰੇਕ ਸਮੈਸਟਰ ਦੀ ਆਪਣੀ ਫੀਸ ਹੋਏਗੀ ਜੀ ਹਾਂਜੀ ਜੀ ਉਰੇ ਐਡਮੀਸ਼ਨਜ਼ ਸ਼ੁਰੂ ਹੋਣੀਆਂ ਜੀ ਸਾਲ ਸਾਲ ਦੇ ਮਿਡ 'ਚ ਸ਼ੁਰੂ ਹੁੰਦੀਆਂ ਨੇ ਜੀ ਮਤਲਬ ਲਾ ਲਉ ਜੁਲਾਈ ਤੋਂ ਜੁਲਾਈ ਤੋਂ ਸ਼ੁਰੂ ਹੁੰਦੀਆਂ ਨੇ ਜੀ ਫਿਰ ਉਹ ਅਗਸਤ ਤੱਕ ਜਾ ਕੇ ਖਤਮ ਹੁੰਦੀਆਂ ਨੇ ਜੀ ਤੁਸੀਂ ਜਦ ਮਰਜ਼ੀ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ ਆਰਾਮ ਨਾਲ ਹਾਂਜੀ ਹੋਰ ਹਾਂਜੀ ਤੁਸੀਂ ਕਦੋਂ ਵੀ ਵਿਜਿਟ ਕਰ ਸਕਦੇ ਓਂ ਓ ਉੱਥੇ ਆ ਕੇ ਜੀ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਕੋਲ ਕਰ ਸਕਦੇ ਓਂ ਮੈਂ ਤੁਹਾਨੂੰ ਪੂਰੀ ਤਰ੍ਹਾਂ ਗਾਈਡ ਕਰਾਂਗਾ ਹਾਂਜੀ ਥੈਂ ਥੈਂਕ ਯੂ ਜੀ ਜੇ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਤੁਸੀਂ ਮੈਨੂੰ ਕੋਲ ਕਰ ਸਕਦੇ ਜੀ ਠੀਕ ਹੈ ਜੀ